ਪੌਦੇ ਉਗਾਉਣ ਲਈ ਆਮ ਤੌਰ 'ਤੇ ਜਿਹੜੀ ਅਸੀਂ ਮਿਕਸ ਮਿੱਟੀ ਦੀ ਓ ਵਰਤੋਂ ਕਰਦੇ ਹਾਂ ਬਹੁਤ ਜ਼ਿਆਦਾ ਚਿੱਕਣੀ ਵੀ ਨਹੀਂ ਹੋਣੀ ਚਾਹੀਦੀ ਅਤੇ ਬਹੁਤ ਜ਼ਿਆਦਾ ਜਿਹੜੀ ਮਿੱਟੀ ਹੈ ਉਹ ਰੇਤਲੀ ਵੀ ਨਾ ਹੋਵੇ ਅਤੇ ਜਦੋਂ ਅਸੀਂ ਪੌਦੇ ਲਗਾਉਣੇ ਆ ਤਾਂ ਸਾਨੂੰ ਚਾਹੀਦਾ ਕਿ ਪਹਿਲਾਂ ਅਸੀਂ ਉਹਦੇ ਵਿੱਚ ਮਿੱਟੀ ਦੇ ਵਿੱਚ ਕੋਈ ਨਾ ਕੋਈ ਖਾਦ ਵਗੈਰਾ ਐਡ ਕਰ ਲਈਏ ਤਾਂ ਕਿ ਪੌਦੇ ਜਿਹੜੀ ਗਰੌਥ ਹੈ ਉਹਨਾਂ ਦੀ ਵਧੀਆ ਰਹੇ ਉਹਨਾਂ ਦਾ ਉਤਪੱਤੀ ਜਿਹੜੀ ਵਧੀਆ ਹੋਵੇ ਸੋ ਮੈਂ ਜ਼ਿਆਦਾਤਰ ਯੂਜ਼ ਕਰਦੀ ਹਾਂ ਦੇਸੀ ਖਾਦ ਜਿਵੇਂ ਢੇਰ ਦੇਸੀ ਢੇਰ ਲੈ ਕੇ ਆਪਾਂ ਹੈ ਨਾ ਪੁਰਾਣਾ ਢੇਰ ਹੋਵੇ ਜਿਹੜਾ ਅਤੇ ਉਹ ਵਾਲੀ ਖਾਦ ਉਹ ਪਾ ਦਿੰਦੇ ਹਾਂ ਜਾਂ ਮਤਲਬ ਜਿਵੇਂ ਅਸੀਂ ਸਬਜ਼ੀਆਂ ਵਗੈਰਾ ਕੱਟਦੇ ਹਾਂ ਘਰੇ ਜਿਹੜਾ ਉਹ ਵੇਸਟ ਹੁੰਦਾ ਏ ਆ ਉਹ ਉਹਦੀ ਖਾਦ ਬਣਾ ਲੈਂਦੇ ਹਾਂ ਉਹਨਾਂ ਨੂੰ ਇੱਕ ਟੋਏ 'ਚ ਟੱਬ ਦੱਬ ਕੇ ਹੈ ਨਾ ਜਿੱਦਾਂ ਜਿਹੜਾ ਹੈਗਾ ਜਾਂ ਪੱਤਿਆਂ ਨੂੰ ਇੱਕ ਟੋਏ ਵਿੱਚ ਦੱਬ ਕੇ ਉੱਪਰ ਮਿੱਟੀ ਪਾ ਕੇ ਜਿਹੜੀ ਉਹ ਖਾਦ ਬਣਾਈ ਜਾਂਦੀ ਹੈ ਕੰਪੋਸਟ ਵਗੈਰਾ ਉਹ ਪਾਉਂਦੀ ਆ ਮੈਂ ਹੈ ਨਾ ਕਦੀ ਕਦੀ ਰਸਾਇਣਿਕ ਖਾਦਾਂ ਵੀ ਪਾ ਲੈਂਦੇ ਹਾਂ ਪਰ ਜ਼ਿਆਦਾ ਨਹੀਂ ਘੱਟ ਪਾਉਂਦੇ ਹਾਂ ਇਸ ਤੋਂ ਇਲਾਵਾ ਜਿੱਦਾਂ ਮੰਨ ਲਓ ਪੌਦਿਆਂ 'ਤੇ ਕੀੜਾ ਲੱਗਿਆ ਏ ਤਾਂ ਉਹਨੂੰ ਬਚਾਉਣ ਲਈ ਉਹ ਛਿੜਕਾਅ ਵਗੈਰਾ ਕਰਨਾ ਜਿਹੜੀ ਦੇਸੀ ਦਵਾਈਆਂ ਬਜ਼ਾਰੋਂ ਲੈ ਕੇ ਅਤੇ ਮੋਸਟਲੀ ਕੀੜਿਆਂ ਤੋਂ ਬਚਾਉਣ ਲਈ ਜਿਹੜੇ ਮੇਰੇੇ ਛੋਟੇ ਪੌਦੇ ਆ ਜਾਂ ਮੇਰੇ ਸਬਜ਼ੀਆਂ ਵਗੈਰਾ ਵਾਲੇ ਹੈਗੇ ਆ ਉਹਨਾਂ ਦੇ ਉੱਤੇ ਮੈਂ ਚੁੱਲ੍ਹੇ ਦੀ ਸਵਾਹ ਜਾਂ ਭੱਠੀ ਦੀ ਸਵਾਹ ਦਾ ਛਿੜਕਾਅ ਕਰਨਾ ਪਸੰਦ ਕਰਦੀ ਹਾਂ ਇੱਕ ਤਾਂ ਉਹਦੇ ਨਾਲ਼ ਜਿਹੜੀਆਂ ਸਬਜ਼ੀਆਂ ਦੇ ਵਿੱਚ ਉਹ ਕੈਮੀਕਲ ਨਹੀਂ ਰਲਦੇ ਹੈਗੇ ਤਾਂ ਉਹ ਸ਼ੁੱਧ ਸਬਜ਼ੀਆਂ ਹੁੰਦੀਆਂ ਸਾਡੀਆਂ ਸੋ ਇਹਨਾਂ ਦੀ ਸਾਂਭ ਸੰਭਾਲ ਕਰਨੀ ਜਿਹੜੀ ਬੜੀ ਢੰਗ ਨਾਲ਼ ਕਰਨੀ ਪੈਂਦੀ ਹੈ ਅਤੇ ਜੇ ਅਸੀਂ ਵੱਡੇ ਪੱਧਰ ਦੀ ਕੋਈ ਸਾਡੀ ਹੈਗੀ ਹੈ ਬਗ਼ੀਚੀ ਵਗੈਰਾ ਜਾਂ ਕੁਝ ਵੀ ਹੈ ਤਾਂ ਉੱਥੇ ਅਸੀਂ ਗੰਡੋਇਆਂ ਵਾਲੀ ਖਾਦ ਵੀ ਵਰਤ ਸਕਦੇ ਹਾਂ ਜਿਹੜੀ ਸਭ ਤੋਂ ਵੱਧ ਫਾਇਦੇਮੰਦ ਹੈ ਕਿਉਂਕਿ ਇਹ ਜਿਹੜੀ ਹੈ ਗੰਡੋਏ ਵਗੈਰਾ ਮਿੱਟੀ ਨੂੰ ਪੋਲਾ ਰੱਖਦੇ ਆ ਪੋਲਾ ਰੱਖਣ ਨਾਲ਼ ਕੀ ਹੁੰਦਾ ਕਿ ਜਿਹੜਾ ਉਹਨੂੰ ਫੈਲਣ ਲਈ ਥਾਂ ਮਿਲਦੀ ਆ ਅਤੇ ਉਹ ਪੌਦੇ ਦੀ ਜਿਹੜੀ ਗ੍ਰੋਥ ਹੈ ਉਹ ਵਧੀਆ ਹੋ ਜਾਂਦੀ ਹੈ ਸੋ ਦੇਖਣਾ ਪੈਂਦਾ ਕਿ ਕਿਹੜੇ ਟਾਈਮ ਪੌਦੇ ਨੂੰ ਕਿਹੜੀ ਲੋੜ ਹੈ ਅਤੇ ਉਸ ਹਿਸਾਬ ਨਾਲ਼ ਹੀ ਉਹ ਖਾਦਾਂ ਜਿਹੜੀਆਂ ਵਰਤ ਲਈਆਂ ਜਾਂਦੀਆਂ ਤਾਂ ਕਿ ਜਿਹੜੇ ਸਾਡੇ ਪੌਦੇ ਤੰਦਰੁਸਤ ਦਿਖਣ ਅਤੇ ਵਧੀਆ ਪ੍ਰੋਡਕਟ